ਹਾਂਜੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਕੱਪੜੇ ਧੋਣ ਲਈ ਕੀ ਕਰਦੇ ਹੋ ਅਤੇ ਉਨ੍ਹਾਂ ਨੂੰ ਕਿਵੇਂ ਸੁਕਾਉਂਦੇ ਹੋ ਇਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਕੱਪੜੇ ਧੋਣ ਲਈ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਅੱਜ ਕੱਲ੍ਹ ਸਰਫ਼ ਆ ਰਹੇ ਆ ਜਿਵੇਂ ਸਰਫ਼ ਐਕਸਲ ਨਿਰਮਾ ਵਾਸ਼ਿੰਗ ਪਾਊਡਰ ਹੈਂਕੋ ਇਸ ਤਰ੍ਹਾਂ ਦੀਆਂ ਬਹੁਤ ਵਿਰਾਈਟੀਆਂ ਨੇ ਜਿਹੜੀਆਂ ਬਜ਼ਾਰ ਦੇ ਵਿੱਚ ਅਲੱਗ ਅਲੱਗ ਸਟੋਰਾਂ ਦੇ ਵਿੱਚ ਜਿਵੇਂ ਐਮਾਜੋਨ ਸਟੋਰ ਹੋ ਗਏ ਵੱਡੇ ਵੱਡੇ ਮੋਲ ਖੁੱਲ੍ਹ ਗਏ ਅੱਜ ਇਹ ਸਾਰਾ ਕੁਛ ਕੀ ਹੈ ਉੱਥੇ ਮੁਹੱਈਆ ਹੋ ਜਾਂਦਾ ਹੈ ਇਸ ਤੋਂ ਇਲਾਵਾ ਲਿਕਡ ਵੀ ਆਉਂਦਾ ਜਿਵੇਂ ਸਰਦੀਆਂ ਵਾਲੇ ਕੱਪੜੇ ਆ ਉਨ੍ਹਾਂ ਨੂੰ ਧੋਣ ਵਾਸਤੇ ਇੱਕ ਲਿਕਡ ਪਾਊਡਰ ਆਉਂਦਾ ਬਾਕੀ ਕੱਪੜੇ ਧੋਣ ਵਾਸਤੇ ਵੀ ਲਿਕਡ ਦੇ ਵਿੱਚ ਆ ਰਹੇ ਅਸੀਂ ਉਹਦਾ ਇਸਤੇਮਾਲ ਕਰਕੇ ਕੀ ਆ ਕੱਪੜਿਆਂ ਨੂੰ ਧੋਂਦੇ ਹਾਂ ਅੱਜ ਕੱਲ੍ਹ ਹਰੇਕ ਪਰਿਵਾਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੀ ਸੁਵਿਧਾ ਹੈ ਜਿਹਦੇ ਨਾਲ ਕੀ ਆ ਕੱਪੜੇ ਆਸਾਨੀ ਦੇ ਨਾਲ ਜਲਦੀ ਧੋਤੇ ਜਾਂਦੇ ਆ ਅਤੇ ਮਸ਼ੀਨਾਂ ਦੇ ਵਿੱਚ ਇੱਦਾਂ ਦਾ ਵੀ ਸਿਸਟਮ ਹੈ ਨਾਲ ਦੀ ਨਾਲ ਕੱਪੜੇ ਕੀ ਆ ਸੁੱਕ ਜਾਂਦੇ ਆ ਇਹ ਕੱਪੜੇ ਅੱਧ ਸੁੱਕੇ ਤਾਂ ਮਸ਼ੀਨ ਹੀ ਕਰ ਦਿੰਦੀ ਆ ਜਦੋਂ ਅਸੀਂ ਬਾਹਰ ਅਸੀਂ ਸੁਕਾਉਂਦੇ ਹਾਂ ਘਰਾਂ ਦੇ ਵਿੱਚ ਕੀ ਆ ਛੱਤਾਂ ਦੇ ਉੱਪਰ ਅੱਜ ਕੱਲ੍ਹ ਤਾਰ ਵਾਇਰ ਜਾਂ ਕੋਈ ਰੱਸੀ ਬੰਨ ਦਿੰਦੇ ਹਾਂ ਅਗਰ ਕੱਪੜੇ ਜ਼ਿਆਦਾ ਨੇ ਤਾਂ ਅਸੀਂ ਉਹ ਤਾਰ ਦੇ ਉੱਤੇ ਪਾ ਦਿੰਦੇ ਹਾਂ ਅਗਰ ਮੌਸਮ ਖ਼ਰਾਬ ਹੁੰਦਾ ਧੁੱਪ ਜ਼ਿਆਦਾ ਆ ਜਿਹਦੇ ਨਾਲ ਕੱਪੜੇ ਖ਼ਰਾਬ ਹੁੰਦੇ ਆ ਤਾਂ ਉਹਨੂੰ ਅਸੀਂ ਅੰਦਰ ਵੀ ਪਾ ਦਿੰਦੇ ਹਾਂ ਛਾਂ ਦੇ ਵਿੱਚ ਵੀ ਕੱਪੜਾ ਖ਼ਰਾਬ ਨਾ ਹੋਵੇ ਅੱਜ ਕੱਲ੍ਹ ਵੱਡੇ ਵੱਡੇ ਸਟੋਰਾਂ ਦੇ ਵਿੱਚ ਸਟੈਂਡ ਆ ਰਹੇ ਆ ਕੱਪੜੇ ਸੁਕਾਉਣ ਵਾਲੇ ਜਿਨ੍ਹਾਂ ਕੋਲ ਜਗ੍ਹਾ ਦੀ ਕਮੀ ਆ ਘਰ ਛੋਟੇ ਆ ਉਹ ਕੀ ਆ ਸਟੈਂਡ ਲਿਆਉਂਦੇ ਆ ਉਹ ਸਟੈਂਡ ਦੇ ਉੱਪਰ ਕੀ ਹੈ ਆਪਣੇ ਕੱਪੜੇ ਸੁੱਕਣੇ ਪਾ ਦਿੰਦੇ ਆ ਤਾਂ ਉਹਦੇ ਨਾਲ ਵੀ ਕੱਪੜੇ ਕੀ ਆ ਆਸਾਨੀ ਦੇ ਨਾਲ ਸੁੱਕ ਜਾਂਦੇ ਆ ਅਗਰ ਮੌਸਮ ਖ਼ਰਾਬ ਹੁੰਦਾ ਤਾਂ ਜਿਹੜੇ ਤੁਹਾਡੇ ਉਹ ਕੱਪੜੇ ਆ ਉਹ ਸਟੈਂਡ ਦੇ ਉੱਤੇ ਰੱਖ ਕੇ ਪੱਖਾ ਚਲਾ ਕੇ ਪੱਖੇ ਦੀ ਹਵਾ ਦੇ ਨਾਲ ਵੀ ਜਲਦੀ ਕੱਪੜੇ ਸੁਕਾਏ ਜਾਂਦੇ ਆ ਹੋਰ ਵੀ ਬਹੁਤ ਤਰੀਕੇ ਆ ਕੱਪੜੇ ਸੁਕਾਉਣ ਦੇ ਜਿਵੇਂ ਕੋਈ ਗਰਮ ਆ ਜਿਵੇਂ ਸਰਦੀਆਂ ਦੇ ਵਿੱਚ ਰੂਮ ਹੀਟਰ ਵਗੈਰਾ ਲਾ ਦਿੰਦੇ ਆ ਉਹਦੀ ਗਰਮਾਇਸ਼ ਦੇ ਨਾਲ ਵੀ ਜਿਹੜੇ ਕੱਪੜੇ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੁਕਾਏ ਜਾਂਦੇ ਹਨ ਧੰਨਵਾਦ ਜੀ